ਅਸੀਂ ਪੰਜਾਬੀ ਬੋਲਣ ਲੱਗੇ ਬਹੁਤ ਸਾਰੇ ਸ਼ਬਦਾਂ ਅਤੇ ਵਾਕੰਸ਼ਾਂ ਦੀ ਵਰਤੋਂ ਕਰਦੇ ਹਾਂ ਪਰ ਮੇਰੇ ਮਨਪਸੰਦ ਵਾਕੰਸ਼ ਕਈ ਤਰ੍ਹਾਂ ਦੇ ਹਨ ਜਿਵੇਂ ਕਿ ਵਾਕੰਸ਼ ਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡਦੇ ਹਾਂ ਨਾਮ ਵਾਕੰਸ਼ਾਂ ਨਾਮ ਵਾਕੰਸ਼ ਅਤੇ ਕਿਰਿਆ ਵਾਕੰਸ਼ ਜਿਵੇਂ ਕਿ ਮੈਂ ਇੱਕ ਉਦਾਹਰਨ ਦੇ ਤੌਰ 'ਤੇ ਦੱਸਾਂ ਬੱਚਾ ਰੋਂਦਾ ਹੈ ਤਾਂ ਇਸ ਵਿੱਚ ਜੋ ਬੱਚਾ ਹੈ ਉਹ ਨਾਮ ਹੈ ਅਤੇ ਰੋਂਦਾ ਹੈ ਉਹ ਉਸਦੀ ਕਿਰਿਆ ਹੈ ਤਾਂ ਇਸ ਤਰੀਕੇ ਨਾਲ ਅਸੀਂ ਰੋਜ਼ਾਨਾ ਵਰਤੋਂ ਵਿੱਚ ਬਹੁਤ ਤਰ੍ਹਾਂ ਦੇ ਵਾਕੰਸ਼ ਵਰਤਦੇ ਹਾਂ ਮੈਨੂੰ ਪੰਜਾਬੀ ਦੇ ਮੂਲ ਬੁਲਾਰੇ ਹੋਣ 'ਤੇ ਬਹੁਤ ਜ਼ਿਆਦਾ ਮਾਣ ਹੈ ਕਿਉਂਕਿ ਇਸ ਨਾਲ ਮੈਂ ਆਪਣੀ ਮਾਂ ਬੋਲੀ ਨਾਲ ਜੁੜੀ ਹੋਈ ਹਾਂ ਅਤੇ ਜੋ ਆਪਣੀ ਮਾਂ ਬੋਲੀ ਨਾਲ ਜੁੜ ਕੇ ਮਾਂ ਬੋਲੀ ਦੀ ਕਦਰ ਕਰਦਾ ਹੈ ਉਹ ਉਸਦੀ ਪੰਜਾਬੀ ਹੋਣ ਦੀ ਪਹਿਚਾਣ ਬਣਾਉਂਦਾ ਹੈ